ਹਾਂਜੀ ਮੈਂ ਫਿਊਜ਼ਨ ਪਕਵਾਨਾਂ ਦਾ ਪ੍ਰਯੋਗ ਬਹੁਤ ਜ਼ਿਆਦਾ ਕੀਤਾ ਹੈ ਮੈਂ ਹਰ ਤਰ੍ਹਾਂ ਦਾ ਪਕਵਾਨ ਬਣਾ ਬਣਾਇਆ ਹੈ ਜਿਹਦੇ ਵਿੱਚ ਮੈਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਅਤੇ ਜਿਵੇਂ ਕਿ ਚਾਈਨੀਜ਼ ਫੂਡ ਦੇ ਵਿੱਚ ਆਪਾਂ ਜਿਵੇਂ ਕਿ ਨਿਊਡਲ ਮਨਚੂਰੀਅਨ ਆਪਣਾ ਨਿਊਡਲ ਬਣਾਏ ਨੇ ਮਨਚੂਰੀਅਨ ਬਣਾਇਆ ਹੈ ਫਰਾਈਡ ਰਾਈਜ਼ ਬਣਵਾਏ ਨੇ ਚੀਸ ਚਿਲੀ ਬਣਾਇਆ ਹੈ ਅਤੇ ਸਾਊਥ ਇੰਡੀਅਨ ਵਿੱਚ ਵੀ ਮੈਂ ਬਹੁਤ ਤਰ੍ਹਾਂ ਦੀਆਂ ਡਿਸ਼ਾਂ ਬਣਾਈਆਂ ਨੇ ਜਿਵੇਂ ਮਸਾਲਾ ਡੋਸਾ ਹੋ ਗਿਆ ਆਪਣਾ ਇਡਲੀ ਹੋ ਗਿਆ ਸਾਂਬਰ ਹੋ ਗਿਆ ਇਸ ਤੋਂ ਇਲਾਵਾ ਮੈਂ ਸਾਉਥ ਆਪਣਾ ਉਹਦੇ ਵਿੱਚ ਸੈਂਡਵਿਚ ਵੀ ਬਣਾਏ ਨੇ ਸੈਂਡਵਿਚ ਪੀਜ਼ਾ ਬਰਗਰ ਔਰ ਆਪਣਾ ਫਰੈਂਚ ਫਰਾਈ ਵਗੈਰਾ ਹੋ ਗਈ ਆਲੂ ਦੀ ਟਿੱਕੀ ਹੋ ਗਈ ਇਹ ਚੀਜ਼ਾਂ ਮੈਂ ਹਰ ਤਰ੍ਹਾਂ ਦੀ ਫਿਊਜ਼ਨ ਪਕਵਾਨਾਂ ਦਾ ਪ੍ਰਯੋਗ ਕੀਤਾ ਹੈ ਅਤੇ ਜਿਹਦੇ ਵਿੱਚ ਕਿ ਮੈਂ ਇਸ ਤੋਂ ਇਲਾਵਾ ਮੈਂ ਤੰਦੂਰ ਦੇ ਵਿੱਚ ਵੀ ਰੋਟੀਆਂ ਪਕਾਈਆਂ ਨੇ ਪਰੌਂਠੇ ਪਕਾਏ ਨੇ ਅਤੇ ਆਪਣਾ ਆਪਣਾ ਪਨੀਰ ਟਿੱਕਾ ਬਣਾਇਆ ਹੈ ਉਸ ਤੋਂ ਇਲਾਵਾ ਮੈਂ ਹੋਰ ਵੀ ਬੜੇ ਬੜੇ ਤਰ੍ਹਾਂ ਦੇ ਪਕਵਾਨ ਬਣਾਏ ਹਨ ਜਿਹਦੇ ਵਿੱਚ ਕਿ ਮੈਂ ਆਪਣਾ ਔਰ ਆਪਣਾ ਚੀਜ਼ ਚੀਲੀ ਹੋ ਗਿਆ ਮਨਚੂਰੀਅਨ ਹੋ ਗਿਆ ਚੀਜ਼ ਚੀਲੀ ਗ੍ਰੇਵੀ ਵੀ ਬਣਾਈ ਹੈ ਮ ਸ ਸਪਰਿੰਗ ਰੋਲ ਵੀ ਬਣਾਏ ਨੇ ਹੋਰ ਕੀ ਮੈਂ ਇਸ ਤੋਂ ਇਲਾਵਾ ਚੀਜ਼ ਕੋਨ ਰੋਲ ਵੀ ਬਣਾਏ ਹਨ ਅਤੇ ਬਹੁਤ ਤਰ੍ਹਾਂ ਦੀ ਡਿਸ਼ਾਂ ਮੈਂ ਤਿਆਰ ਕੀਤੀਆਂ ਹਨ